ਖੇਡਾਂ ਲੋਕਾਂ ਲਈ ਇੱਕ ਤਰ੍ਹਾਂ ਸਟਰੈੱਸ ਰਹਿਤ ਅਤੇ ਆਨੰਦ ਦਾ ਇੱਕ ਆਊਟਲੈੱਟ ਪ੍ਰਦਾਨ ਕਰਦੀਆਂ ਹਨ ਜਿਵੇਂ ਖੇਡਾਂ ਖੇਡਣ ਨਾਲ ਬੰਦਿਆਂ ਦੇ ਸਰੀਰ ਵਿੱਚ ਗਤੀਵਿਧੀ ਹੁੰਦੀ ਹੈ ਬੰਦਿਆਂ ਦਾ ਸਰੀਰ ਸਟਰੌਂਗ ਦਾ ਹੈ ਤਾਕਤਵਰ ਬਣਦਾ ਹੈ ਤਾਕਤਵਰ ਹੋਣ ਨਾਲ ਕੋਈ ਸਰੀਰ ਨੂੰ ਬਿਮਾਰੀ ਨਹੀਂ ਲੱਗਦੀ ਅਗਰ ਬੰਦੇ ਵਿੱਚ ਕੋਈ ਬਿਮਾਰੀ ਨਾ ਹੋਵੇ ਤਾਂ ਉਹ ਓਟੋਮੈਟੀਕਲੀ ਸਟਰੈੱਸ ਫ੍ਰੀ ਰਹਿੰਦਾ ਹੈ ਸਵਸਥ ਹੋਣ ਨਾਲ ਸਕਾਰਾਤਮਕ ਸੋਚ ਤਾਂ ਹੈ ਨਕਾਰਾਤਮਕ ਗੱਲਾਂ ਦਿਮਾਗ ਵਿੱਚ ਨਹੀਂ ਆਉਂਦੀਆਂ ਖੇਡਾਂ ਖੇਡਣ ਨਾਲ ਬੰਦਾ ਬਿਜ਼ੀ ਹੋ ਜਾਂਦਾ ਹੈ ਅਗਰ ਬਿਜ਼ੀ ਹੋ ਜਾਏ ਤਾਂ ਓਹਦਾ ਧਿਆਨ ਸਟਰੈੱਸ ਵਿਚ ਵੱਲ ਕਿਸੇ ਤਕਲੀਫ਼ ਵੱਲ ਨਹੀਂ ਜਾਂਦਾ ਉਹ ਤਣਾਅ ਨੂੰ ਕੁਝ ਸਮੇਂ ਲਈ ਭੁੱਲ ਜਾਂਦਾ ਹੈ ਖੇਡਾਂ ਖੇਡਣ ਨਾਲ ਲੋਕਾਂ 'ਚ ਆਪਸੀ ਮੇਲ ਜੋਲ ਵੱਧਦਾ ਹੈ ਮੇਲ ਜੋਲ ਵਧਣ ਨਾਲ ਭਾਈਚਾਰੇ ਦੀ ਭਾਵਨਾ ਪੈਦਾ ਹੁੰਦੀ ਹੁਣ ਜਦੋਂ ਵੀ ਕੋਈ ਸਟਰੈੱਸ ਹੁੰਦਾ ਹੈ ਭਾਈਚਾਰਾ ਵਧਣ ਨਾਲ ਉਹ ਸਾਨੂੰ ਜੋ ਸਟਰੈੱਸ ਹੁੰਦਾ ਹੈ ਕਿਸੇ ਗੱਲ 'ਤੇ ਵੀ ਹੱਲਾਸ਼ੇਰੀ ਦਿੰਦੇ ਹਨ ਕਿ ਕਿਸੇ ਸਮੱਸਿਆ ਦਾ ਹੱਲ ਕਿਵੇਂ ਕੀਤਾ ਜਾਵੇ ਇਸ ਤਰ੍ਹਾਂ ਖੇਡਾਂ ਇੱਕ ਵਧੀਆ ਸਾਧਨ ਹਨ